ਹਾਂ ਕਾਨੂੰਨ ਪ੍ਰਣਾਲੀ ਸਾਰੇ ਦੇਸ਼ ਦੀ ਅੰਸ਼ਕ ਹੈ ਅੱਜ ਕਿਸੇ ਤਬਕੇ 'ਚ ਵੀ ਵੇਖ ਲਵੋ ਹਰ ਪਾਸੇ ਅਵਿਸ਼ਵਾਸ ਦਾ ਬੋਲ ਬਾਲਾ ਹੈ ਜੇ ਨਸ਼ੇ ਦੀ ਗੱਲ ਕਰੀਏ ਤਾਂ ਅੱਜ ਸਾਡੇ ਦੇਸ਼ ਦੀ ਨਵ ਪੀੜ੍ਹੀ ਨੌਜਵਾਨ ਤਬਕਾ ਨਸ਼ੇ ਨਾਲ ਗ੍ਰਸਤ ਹੋ ਰਿਹਾ ਹੈ ਇੱਕ ਕਾਰਨ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਹੈ ਦੂਜਾ ਕਾਰਨ ਹੈ ਕਿ ਅੰਨੇ ਵਾਹ ਨਸ਼ਾ ਮਿਲਣਾ ਨਸ਼ੇ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੇ ਨਸ਼ਾ ਤਸਕਰਾਂ ਨੂੰ ਤਾਂ ਫੜਿਆ ਨਹੀਂ ਜਾਂਦਾ ਇਸ ਤੋਂ ਅੱਗੇ ਜਿਹੜੇ ਛੋਟੇ ਨਸ਼ਾ ਵੇਚਣ ਵਾਲੇ ਹੁੰਦੇ ਹਨ ਸਪਲਾਈ ਕਰਦੇ ਹਨ ਉਹਨਾਂ 'ਤੇ ਜੋਰ ਚਲ ਜਾਂਦਾ ਹੈ ਸਰਕਾਰ ਦਾ ਕੀ ਨਸ਼ਾ ਖਤਮ ਨਹੀਂ ਹੋ ਸਕਦਾ ਹੋ ਸਕਦਾ ਹੈ ਜੇ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਕਾਨੂੰਨ ਹਵਾਲੇ ਕਰੇ ਦੇਸ਼ ਵਿਚੋਂ ਨਸ਼ਾ ਖਤਮ ਹੋਵੇਗਾ ਜੇ ਭਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਭ੍ਰਿਸ਼ਟਾਚਾਰ ਹਰ ਪਾਸੇ ਫੈਲਿਆ ਹੋਇਆ ਹੈ ਕਿਸੇ ਤਬਕੇ ਕਿਸੇ ਮਹਿਕਮੇ ਵਿੱਚ ਵੀ ਦੇਖਿਆ ਜਾਵੇ ਤਾਂ ਲੋਕ ਰਿਸ਼ਵਤ ਖੋਰੀ ਨੂੰ ਪਹਿਲ ਦਿੰਦੇ ਹਨ ਕੋਈ ਕੰਮ ਕਰਵਾਉਣਾ ਹੋਵੇ ਤਾਂ ਪਹਿਲਾਂ ਰਿਸ਼ਵਤ ਮੰਗੀ ਜਾਂਦੀ ਹੈ ਕੀ ਅਜੇ ਅਜਿਹਾ ਹੀ ਸਾਡੇ ਦੇਸ਼ ਦਾ ਰਵੇਗਾ ਜੇ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਬੇਰੁਜ਼ਗਾਰ ਵਿਅਕਤੀ ਵੀ ਅੱਜ ਕਾਨੂੰਨ ਦਾ ਸਹਾਰਾ ਲੈਂਦੇ ਹਨ ਪਰ ਉਹਨਾਂ ਨਾਲ ਇਨਸਾਫ ਨਹੀਂ ਮਿਲਦਾ ਜਿਹੜੇ ਲੋਕ ਭੁੱਖ ਹੜਤਾਲ 'ਤੇ ਬੈਠਦੇ ਹਨ ਧਰਨੇ ਦਿੰਦੇ ਹਨ ਉਹਨਾਂ ਨੂੰ ਜਬਰ ਦੀ ਜਬਰੀ ਕਰਕੇ ਉਹਨਾਂ 'ਤੇ ਡਾਂਗ ਵਰ੍ਹਾ ਕੇ ਮਾਰ ਕੁਟਾਈ ਕਰਕੇ ਉਹਨਾਂ ਨੂੰ ਉਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਇਹ ਇਸ ਮਸਲੇ ਦਾ ਹੱਲ ਹੈ ਮਾੜੇ ਅਤੇ ਗਰੀਬ ਤਬਕੇ ਤੋਂ ਅਮੀਰ ਤਬਕਾ ਵੀ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾੜੇ ਲੋਕਾਂ ਨੂੰ ਇਸ ਦਾ ਵੀ ਇਨਸਾਫ ਨਹੀਂ ਮਿਲਦਾ ਇਸ ਤਰ੍ਹਾਂ ਸਾਡਾ ਦੇਸ਼ ਤਰੱਕੀ ਨਹੀਂ ਕਰੇਗਾ ਬਾਹਰਲੇ ਮੁਲਕਾਂ 'ਚ ਦੇਖਿਆ ਜਾਵੇ ਤਾਂ ਲੋਕਾਂ ਨੂੰ ਕਾਨੂੰਨ ਦਾ ਪੂਰਾ ਸ ਅਤੇ ਸਹੀ ਸਹਾਰਾ ਮਿਲਦਾ ਹੈ ਸਊਦੀ ਅਰਬ ਵਰਗੇ ਮੁਲਕਾਂ ਵਿਚ ਹਰ ਜਗ੍ਹਾ 'ਤੇ ਕਾਨੂੰਨ ਸ ਸਹੀ ਹੈ ਲੋਕਾਂ ਨੇ ਜੇ ਕਿਸੇ ਨੇ ਕੋਈ ਗਲਤ ਕੰਮ ਕਰਦਾ ਹੈ ਉਸ ਨੂੰ ਉਸ ਦੀ ਸਜ਼ਾ ਉਸੇ ਵਕਤ ਹੀ ਦਿੱਤੀ ਜਾਂਦੀ ਹੈ ਸਾਡੇ ਦੇਸ਼ ਨੂੰ ਅੱਜ ਜ਼ਰੂਰਤ ਹੈ ਬਚਾਉਣ ਦੀ ਆਓ ਰਲ ਕੇ ਸਰਕਾਰ ਦੇ ਨਾਲ ਮਿਲ ਕੇ ਇਸ ਪਾਸੇ ਵੱਲ ਕਦਮ ਉਠਾਈਏ